ਨਮਸਕਾਰ ਜੀ ਸਰ ਸਰ ਮੇਰੇ ਲਾਗੇ ਨਾ ਬਿਲਕੁਲ ਜੀ ਇੱਕ ਇਮਾਰਤ ਡਿੱਗੀ ਡਿਸਟ੍ਰਿਕਟ ਗੁਰਦਾਸਪੁਰ ਹੈ ਜੀ ਪਿੰਡ ਜੀ ਹੱਲਾ 'ਚ ਹੀ ਹੈ ਜੀ ਇਮਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਸਾਹਮਣੇ ਦੀ ਘਟਨਾ ਹੈ ਜੀ ਘਟਨਾ ਇੱਦਾਂ ਹੋਈ ਹੈ ਜੀ ਕੁਛ ਬੰਦੇ ਇੰਜਰਡ ਵੀ ਹੋ ਗਏ ਹੈ ਜੀ ਤੁਸੀਂ ਇਸ ਤਰ੍ਹਾਂ ਕਰੋ ਜੀ ਜਲਦੀ ਜਲਦੀ ਪਹੁੰਚੋ ਰੀਜ਼ਨ ਇਹ ਹੈ ਕਿ ਬੰਦੇ ਲੱਗਦੇ ਹੈ ਕਿ ਵੀਹ ਤੀਹ ਬੰਦੇ ਥੱਲੇ ਦੱਬੇ ਹੋਏ ਨੇ ਵਿੱਚੋਂ ਆਪਾਂ ਸ ਹੈਲਪ ਕੀਤੀ ਆ ਬੰਦਿਆਂ ਨੇ ਪਰ ਹਜੇ ਵੀ ਇੱਥੇ ਹਜੇ ਕੋਈ ਸੁਰੱਕਸ਼ਾ ਕੋਈ ਪੰਜਾਬ ਪੁਲਿਸ ਦਾ ਕੋਈ ਬੰਦਾ ਹਜੇ ਪਹੁੰਚਿਆ ਨਹੀਂ ਆ ਨਾ ਹੀ ਕ ਕਾਰਜ ਵਾਸਤੇ ਕੋਈ ਪੁੱਜਿਆ ਹੈ ਬਹੁਤ ਜ਼ਿਆਦਾ ਨੁਕਸਾਨ ਆ ਲੋਕਾਂ ਦੀ ਚੀਕਾਂ ਵੱਜ ਰਹੀਆਂ ਨੇ ਅਸੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਕਿ ਅਸੀਂ ਹੈਲਪ ਕਰ ਰਹੇ ਹਾਂ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੁਛ ਕੋਈ ਵੀ ਬੰਦਾ ਹਾਜਰ ਨਹੀਂ ਹੋਇਆ ਪਲੀਜ਼ ਕਿਰਪਾ ਕਰਕੇ ਵੱਧ ਤੋਂ ਵੱਧ ਜੀ ਜਲਦੀ ਜਲਦੀ ਜਿਹੜੀ ਕਾਰਜ ਆ ਜਿਹੜੀ ਬਚਾਅ ਕਾਰਜ ਟੀਮ ਭੇਜੋ ਅਤੇ ਐਮਰਜੈਂਸੀ ਸੇਵਾਵਾਂ ਵੀ ਭੇਜੋ ਬਹੁਤ ਸਾਰੇ ਬੰਦੇ ਥੱਲੇ ਹਜੇ ਵੀ ਨ ਪਏ ਹੋਏ ਹਨ ਬਿਲਡਿੰਗ ਬਹੁਤ ਪੁਰਾਣੀ ਸੀ ਸਰ ਪਰ ਇਹਦਾ ਵੀ ਕਾਰਨ ਹੈ ਕਿ ਸਰਕਾਰੀ ਬਿਲਡਿੰਗ ਹੀ ਬਹੁਤ ਜ਼ਿਆਦਾ ਖਸਤਾ ਹਾਲਤ ਇਤ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਅੰਦਰ ਮਜ਼ਦੂਰੀ ਕੰਮ ਚੱਲ ਰਿਹਾ ਅੰਦਰ ਪਲੀਜ਼ ਰਿਕੁਐਸਟ ਆ ਜੀ ਜਲਦੀ ਤੋਂ ਜਲਦੀ ਕਾਰਜ ਟੀਮ ਭੇਜੋ ਹਜੇ ਵੀ ਅੱਧੇ ਘੰਟੇ ਤੋਂ ਵੱਧ ਟਾਈਮ ਹੋ ਗਿਆ ਕਿ ਅਜੇ ਤੱਕ ਟੀਮ ਪੁੱਜੀ ਨਹੀਂ ਹੈ ਮੇਰੀ ਅੱਖਾਂ ਦੇ ਸਾਹਮਣੇ ਬਿਲਡਿੰਗ ਡਿੱਗੀ ਆ ਘੱਟੋ ਘੱਟ ਅੰਦਰ ਪੰਜ ਸੌ ਮਜ਼ਦੂਰ ਕੰਮ ਕਰਦਾ ਜਿਹਨਾਂ 'ਚੋਂ ਜਿਹੜੇ ਬੰਦੇ ਬਜ਼ੁਰਗ ਸੀ ਉਹ ਥੱਲੇ ਨੱਪੇ ਹੋਏ ਹਨ ਕਈ ਬਾਲ ਮਜ਼ਦੂਰੀ ਵਾਲੇ ਵੀ ਅੰਦਰ ਬੱਚੇ ਵੀ ਮੌਜੂਦ ਨੇ ਫੈਮਲੀ ਵਾਲੇ ਉਹ ਵੀ ਆਪਣੇ ਬੱਚਿਆਂ ਨਾਲ ਮਜ਼ਦੂਰੀ ਕਰ ਰਹੇ ਨੇ ਕਿਰਪਾ ਕਰਕੇ ਜਲਦੀ ਜਲਦੀ ਕਾਰਜ ਕਾਰਜ ਬਚਾਅ ਟੀਮ ਭੇਜੋ ਸਰ